ਅਸੀਂ ਆਪਣੀ ਸਿਖਲਾਈ ਅਤੇ ਦੌੜ ਦੀ ਤਿਆਰੀ ਦੇ ਵਿੱਚ ਪੋਸ਼ਣ ਅਤੇ ਹਾਈਡਰੇਸ਼ਨ ਨੂੰ ਬਹੁਤ ਤਰੀਕੇ ਨਾਲ ਸ਼ਾਮਿਲ ਕਰ ਸਕਦੇ ਹਨ ਜਿਵੇਂ ਕਿ ਕਸਰਤ ਵੇ ਦੇ ਵਿੱਚ ਹਾਈਡਰੇਸ਼ਨ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਪਾਣੀ ਦੀ ਮਾਤਰਾ ਮਤਲਬ ਕਿ ਦਿਨ ਵਿੱਚ ਕਮ ਤੋਂ ਕਮ ਅੱਠ ਤੋਂ ਦਸ ਗਲਾਸ ਪਾਣੀ ਪੀਣ ਦੀ ਕੋਸ਼ਿਸ਼ ਕਰੋ ਖਾਸ ਕਰਕੇ ਕਸਰਤ ਕਰਨ ਤੋਂ ਪਹਿਲਾਂ ਅਤੇ ਬਾਅਦ ਦੇ ਵਿੱਚ ਫਿਰ ਸਮੇਂ ਸਮੇਂ 'ਤੇ ਪਾਣੀ ਪੀਣਾ ਵੀ ਇਸ ਵਿੱਚ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਜਿਵੇਂ ਕਿ ਪੰਦਰ੍ਹਾਂ ਵੀਹ ਮਿੰਟ ਵਿੱਚ ਪਾਣੀ ਪੀਤਾ ਤਾਂ ਕਿ ਸਰੀਰ ਨੂੰ ਹਾਈਡਰੇਟ ਹੋਵੇ ਕਸਰਤ ਕਰਨ ਤੋਂ ਪਹਿਲਾਂ ਇਸ ਤੋਂ ਬਿਨਾਂ ਲੈਕਟੋਲਿਕਸਲਾਈਟਸ ਦੀ ਗੱਲ ਕਰੀਏ ਤਾਂ ਲੰਬੀਆਂ ਕਸਰਤਾਂ ਦੇ ਦੌਰਾਨ ਪਦਾਰਥ ਜਿਵੇਂ ਕਿ ਸਪੈਸ਼ਲ ਪਦਾਰਥ ਲੈਣੇ ਚਾਹੀਦੇ ਹਨ ਜਿਵੇਂ ਕਿ ਸਪੈਸ਼ਲ ਡਰਿੰਕ ਆਦਿ ਅਤੇ ਜੇ ਡਾਈਟ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਉਸਦੇ ਵਿੱਚ ਕਾਰਬਨ ਕਾਰਬੋਹਾਈਡਰੇਟ ਪ੍ਰੋਟੀਨ ਚਰਬੀਆਂ ਦਾ ਸੰਤੁਲਨ ਬਣਾਉਣਾ ਪੈਂਦਾ ਹੈ ਜਿਵੇਂ ਕਿ ਪ੍ਰੋਟੀਨ ਦੇ ਵਿੱਚ ਮਾਸ ਦਾਲਾਂ ਆ ਯੋਗਰਟ ਕਾਰਬੋਹਾਈਡਰੇਟਸ ਜਿਵੇਂ ਕਿ ਸਾਬਤ ਅਨਾਜ ਅਤੇ ਫਲ ਅਤੇ ਚਰਬੀ ਜਿਵੇਂ ਕਿ ਮੂੰਗਫਲੀਆਂ ਅਤੇ ਬਦਾਮ ਆਦਿ ਨੂੰ ਸ਼ਾਮਿਲ ਕਰੋ ਜਿਸ ਨਾਲ ਡਾਇਟ ਨੂੰ ਵੀ ਸਹੀ ਹੋਵੇਗਾ ਅਤੇ ਚਰਬੀ ਵੀ ਵਧੇਗੀ ਹਲਕੇ ਭੋਜਨ ਕਸਰਤ ਤੋਂ ਪਹਿਲਾਂ ਹਲਕੇ ਭੋਜਨ ਜਿਵੇਂ ਕਿ ਫਲ ਜਾਂ ਮੂੰਗਫਲੀਆਂ ਦਾ ਪ੍ਰਯੋਗ ਕਰਨਾ ਚਾਹੀਦਾ ਜਿਸ ਨਾਲ ਊਰਜਾ ਊਰਜਾ ਪੈਦਾ ਹੋਵੇਗੀ ਇਸ ਤੋਂ ਬਿਨਾਂ ਬਜ਼ਾਰੋਂ ਪੋਸ਼ਨ ਦੇ ਵਿੱਚ ਗੱਲ ਕਰੀਏ 'ਤੇ ਵਿਟਾਮਿਨ ਮਿਨਰਲ ਨਾਲ ਭਰਪੂਰ ਭੋਜਨ ਖਾਣਾ ਚਾਹੀਦਾ ਜਿਵੇਂ ਕਿ ਹਰੀਆਂ ਸਬਜ਼ੀਆਂ ਜੋ ਕਿ ਸਰੀਰ ਨੂੰ ਰੋਜ਼ਾਨਾ ਜ਼ਰੂਰਤ ਨੂੰ ਪੂਰਾ ਕਰਦੇ ਨੇ ਅਤੇ ਤੰਦਰੁਸਤ ਫੀਲ ਕਰਵਾਉਂਦੇ ਹਨ ਫਿਰ ਇਸ ਦੇ ਨਾਲ ਨਾਲ ਸੰਤੁਲਨ ਬਣਾਈ ਰੱਖਣਾ ਵੀ ਜ਼ਰੂਰੀ ਹੈ ਜਿਵੇਂ ਕਿ ਵਿਅਕਤੀਗਤ ਯੋਜਨਾ ਦੇ ਵਿੱਚ ਆਪਾਂ ਆਪਣੇ ਲਕਸ਼ਾਂ ਅਤੇ ਲੋੜਾਂ ਦੇ ਅਨੁਸਾਰ ਕਸਰਤ ਅਤੇ ਡਾਇਟ ਦੀ ਯੋਜਨਾ ਬਣਾਓ ਹਫਤਾਵਾਰ ਦੀ ਜਾਂਚ ਕਰੋ ਮਤਲਬ ਕਿ ਹਫਤਾਵਾਰ ਵਿੱਚ ਆਪਣੀ ਪ੍ਰਕਿਰਤੀ ਅਤੇ ਖੁਰਾਕ ਦੀ ਜਾਂਚ ਕਰੋ ਤਾਂ ਜੋ ਕੋਈ ਅਸਮਾਨਤਾ ਹੋਵੇ ਤਾਂ ਸਹੀ ਕੀਤੇ ਜਾ ਸਕੇ ਸਮਾਜਿਕ ਸਹਾਇਤਾ ਦੋਸਤਾਂ ਜਾਂ ਪਰਿਵਾਰਾਂ ਨਾਲ ਮਿਲ ਕੇ ਵਰਜਿਸ ਕਰੋ ਜੋ ਮੋਟੀਵੇਸ਼ਨ ਅਤੇ ਸੰਤੁਲਨ ਨੂੰ ਬਰਕਰਾਰ ਰੱਖੇਗਾ ਅਤੇ ਮਦਦਗਾਰ ਹੋਵੇਗੀ ਇਸ ਤਰ੍ਹਾਂ ਹਾਈਡਰੇਸ਼ਨ ਦੇ ਨਾਲ ਸੰਤੁਲਨ ਬਣਾਈ ਰੱਖਣਾ ਅਤੇ ਜੀਵਨ ਸ਼ੈਲੀ ਲਈ ਵੀ ਮੌਤ ਮਹੱਤਵਪੂਰਨ ਹੈ ਇਸ ਤੋਂ ਬਿਨ੍ਹਾਂ ਜੇ ਹੋਰ ਗੱਲ ਕਰੀਏ ਤਾਂ ਸਿਹਤਮੰਦ ਜੀਵਨ ਵਿੱਚ ਵੀ ਹਾਈਡਰੇਟ ਅਤੇ ਸਿਕ ਪੋਸ਼ਨ ਦੋਨੋਂ ਬਹੁਤ ਜ਼ਰੂਰੀ ਹਨ ਹਾਈਡਰੇਸ਼ਨ ਦੇ ਵਿੱਚ ਹੋਰ ਕੀ ਆਉਂਦਾ ਹਾਈਡਰੇਟ ਫੂਡ ਮਤਲਬ ਫਲ ਸਬਜ਼ੀਆਂ ਖਰਬੂਜਾ ਕੱਕੜੀ ਆਦੀ ਜੋ ਕਿ ਪਾਣੀ ਵਿੱਚ ਉੱਚੀ ਮਾਤਰਾ ਦੇ ਵਿੱਚ ਹੁੰਦਾ ਹੈ ਜੋ ਸਰੀਰ ਨੂੰ ਹਾਈਡਰੇਟ ਰੱਖਣ ਵਿੱਚ ਮਦਦ ਕਰਦੀਆਂ ਹਨ ਗਤੀਵਿਧੀਆਂ ਦੌਰਾਨ ਮਤਲਬ ਕੋਈ ਵੀ ਵਿਆਮ ਕਰਨ ਤੋਂ ਬਾਅਦ ਖਾਸ ਕਰਕੇ ਜਦੋਂ ਊਰਜਾ ਵੱਧ ਜਾਂਦੀ ਹੈ ਤਾਂ ਦੋ ਪੀਲਾ ਪਾਣੀ ਪੀਣਾ ਜਾਂ ਸਰੀਰ ਦੀ ਹਾਈਡਰੇਸ਼ਨ ਨੂੰ ਬਰਕਰਾਰ ਰੱਖਦਾ ਹੈ ਸਮੇਂ ਸਮੇਂ 'ਤੇ ਭੋਜਨ ਲੈਣਾ ਵੀ ਇਸ ਵਿੱਚ ਸਹੀ ਹੈ ਛੋਟੇ ਹਰ ਪੋਸ਼ਨ ਨਾਲ ਭਰਪੂਰ ਜੋ ਸਰੀਰ ਨੂੰ ਨਿਰੰਤਰ ਊਰਜਾ ਮੁਹੱਈਆ ਕਰਵਾਉਂਦਾ ਅਤੇ ਇਹ ਥਕਾਵਟ ਅਤੇ ਕਮਜ਼ੋਰੀ ਤੋਂ ਵੀ ਬਚਾਉਂਦਾ ਹੈ ਕੈਫੀਨ ਅਤੇ ਸ਼ੱਕਰ ਦੀ ਮਾਤਰਾ ਕੈਫੀਨ ਅਤੇ ਸ਼ੱਕਰ ਦੀਆਂ ਚੀਜ਼ਾਂ ਨੂੰ ਸੰਤੁਲਿਤ ਰੱਖਣਾ ਕਿਉਂਕਿ ਉਹ ਊਰਜਾ ਦੇ ਸਕਦੀਆਂ ਹਨ ਪਰ ਬਾਅਦ ਵਿੱਚ ਥਕਾਵਟ ਦਾ ਨਾ ਕਰਨ ਵੀ ਬਣ ਸਕਦੀਆਂ ਹਨ ਬਜ਼ਾਰੀ ਭੋਜਨ ਸੰਸਾਰ ਭਰ ਦੇ ਵੱਖਰੇ ਪੁਸ਼ਾਕ ਅਤੇ ਆਹਾਰਾਂ ਨੂੰ ਰੋਜ਼ਾਨਾ ਭੋਜਨ ਵਿੱਚ ਸ਼ਾਮਿਲ ਕਰਨਾ ਜਿਵੇਂ ਕਿ ਫਲ ਅਤੇ ਸਬਜ਼ੀਆਂ ਅਤੇ ਸਾਬਤ ਅਨਾਜ ਜੋ ਸਰੀਰ ਨੂੰ ਜ਼ਰੂਰੀ ਪੋਸ਼ਨ ਪ੍ਰਦਾਨ ਕਰਦੇ ਹਨ ਸੰਤੁਲਨ ਬਣਾਈ ਰੱਖਣ ਦੇ ਲਈ ਆਪਾਂ ਹੋਰ ਕੀ ਕਰ ਸਕਦੇ ਮਨੋਬਲ ਰੱਖਣਾ ਜਿਵੇਂ ਕਿ ਆਪਣੇ ਲਕਸ਼ਾਂ 'ਤੇ ਫੋਕਸ ਕਰੋ ਅਤੇ ਸੈਲਫ ਮੋਟੀਵੇਸ਼ਨ ਲਈ ਪ੍ਰੇਰਿਕ ਗੱਲਾਂ ਜਾਂ ਦ੍ਰਿਸ਼ ਦੇਖੋ ਸਮਾਜਿਕ ਸਮਰਥਨ ਦੇ ਵਿੱਚ ਫਿੱਟਨੈਸ ਸਮੂਹ ਵਿੱਚ ਭਾਗ ਲੈਣਾ ਮੋਟੀਵੇਸ਼ਨ ਦੇਣਾ ਆਦਿ ਆਪਣੀ ਆਵਾਜ਼ ਨੂੰ ਸੁਣੋ ਜੋ ਤੁਹਾਨੂੰ ਕਸਰਤ ਕਰਦੇ ਹੋਏ ਜ਼ਿਆਦਾ ਥਕਾਵਟ ਮਹਿਸੂਸ ਹੋਵੇ ਤਾਂ ਆਰਾਮ ਕਰੋ ਸਰੀਰ ਦੀ ਸੁਣਨ ਵਿੱਚ ਸਮਰੱਥਾ ਬਹੁਤ ਹੀ ਮਹੱਤਵਪੂਰਨ ਹੈ ਗੋਲ ਸੈਟਿੰਗ ਦੇ ਵਿੱਚ ਕੀ ਹੁੰਦਾ ਹੈ ਕਿ ਛੋਟੇ ਅਤੇ ਵੱਡੇ ਗੋਲ ਰੱਖਣਾ ਅਤੇ ਉਹਨਾਂ ਦੀ ਪ੍ਰਕਿਰਤੀ ਦੀ ਜਾਂਚ ਕਰਨਾ ਜੋ ਸੰਤੁਲਿਤ ਬਣਾਈ ਰੱਖਣ ਵਿੱਚ ਥੋੜ੍ਹੀ ਸਹਾਇਤਾ ਹੁੰਦੇ ਹਨ ਇਸ ਇਹ ਸਾਰੇ ਸਰੀਰ ਦੀ ਸਹੁ ਸਿਹਤ ਨੂੰ ਸੁਧਾਰਨ ਅਤੇ ਊਰਜਾ ਵਧਾਉਣ ਵਿੱਚ ਫਿੱਟਨਨ ਫਿੱਟਨੈਸ ਨੂੰ ਨਿਯੰਤਰਨ ਰੱਖਣ ਵਿੱਚ ਮਦਦ ਕਰਦੇ ਨੇ